ਚਿੱਤਰਕਾਰੀ ਕਰਨ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਜੋ ਤਸਵੀਰ ਬਣਾਉਣੀ ਹੈ ਉਸ ਬਾਰੇ ਬਰੀਕ ਤੋਂ ਬਰੀਕ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ ਤਾਂ ਜੋ ਉਸ ਨੂੰ ਅੱਗੇ ਕੋਈ ਮੁਸ਼ਕਿਲ ਨਾ ਆਵੇ ਵਧੀਆ ਉਪਕਰਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਇੱਕ ਮੁੱਢਲੀ ਜ਼ਰੂਰਤ ਹੈ ਚਿੱਤਰਕਾਰੀ ਕਰਨ ਲਈ ਅਕਸਰ ਲੋਕ ਇਹਨਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਚਿੱਤਰਕਾਰੀ ਕਰਦੇ ਸਮੇਂ ਉਹਨਾਂ ਤੋਂ ਕਈ ਗਲਤੀਆਂ ਹੋ ਜਾਂਦੀਆਂ ਹਨ ਇੱਕ ਚੰਗਾ ਚਿੱਤਰਕਾਰੀ ਬਣਨ ਲਈ ਅਭਿਆਸ ਕਰਨ ਦੀ ਕੋਈ ਮਿਆਦ ਨਹੀਂ ਹੈ ਇਸ ਦਾ ਅਭਿਆਸ ਜਿੰਨਾ ਕਰੋਗੇ ਓਨੀ ਤੁਹਾਡੀ ਕਲਾਕਾਰੀ ਯਾ ਚਿੱਤਰਕਾਰੀ ਨਿਖਰ ਕੇ ਲੋਕਾਂ ਦੇ ਸਾਹਮਣੇ ਆਵੇਗੀ ਤਾਂ ਹੀ ਉਹ ਇੱਕ ਚੰਗਾ ਕਲਾਕਾਰ ਬਣ ਸਕਦਾ ਹੈ